ਵੈਸੇ ਤਾਂ ਨਵਾਂਸ਼ਹਿਰ ਇਲਾਕੇ ਦੇ ਨੌਜਵਾਨ ਪੀੜ੍ਹੀ ਬਾਰ੍ਹਾਂ ਪਾਸ ਕਰਕੇ ਬਾਹਰ ਜਾਣ ਦੇ ਜ਼ਿਆਦਾ ਚਾਹਵਾਨ ਹਨ ਕਿ ਕਨੇਡਾ ਅਮਰੀਕਾ ਵਰਗੇ ਵੱਡੇ ਦੇਸ਼ਾਂ ਵਿੱਚ ਜਾ ਕੇ ਰਹਿਣ ਦੇ ਜ਼ਿਆਦਾ ਚਾਹਵਾਨ ਹਨ ਇਸ ਕਰਕੇ ਨਵਾਂਸ਼ਹਿਰ ਦੇ ਵਿੱਚ ਐਨਾ ਐੱਨ ਆਰ ਆਈ ਲੋਕ ਜ਼ਿਆਦਾ ਰਹਿੰਦੇ ਹਨ ਨਵਾਂਸ਼ਹਿਰ ਦੇ ਵਿੱਚ ਡੋਲਰ ਵੀ ਕਾਫੀ ਚੱਲਦਾ ਹੈ ਪਰ ਇਸ ਤੋਂ ਇਲਾਵਾ ਵੀ ਕਈ ਲੋਕ ਇੱਦਾਂ ਦੇ ਨੇ ਜੋ ਇੱਥੇ ਰਹਿ ਕੇ ਪੰਜਾਬ ਦੇ ਵਿੱਚ ਨਵਾਂਸ਼ਹਿਰ ਦੇ ਵਿੱਚ ਕੁਛ ਕਰਨ ਦੇ ਚਾਹਵਾਨ ਹਨ ਇਹਨਾਂ ਵਿੱਚੋਂ ਇੱਕ ਸਾਡੇ ਗੁਆਂਢੀ ਪਿੰਡ ਦਾ ਲੜਕੇ ਦੀ ਕਹਾਣੀ ਹੈ ਜਿਸਨੇ ਬੀਐੱਸਸੀ ਐਗਰੀਕਲਚਰ ਕਰਕੇ ਆਪਣਾ ਘਰ ਦਾ ਵਪਾਰ ਸ਼ੁਰੂ ਕੀਤਾ ਉਸਨੇ ਔਰਗੈਨਿਕ ਖੇਤੀ ਦਾ ਕੰਮ ਸ਼ੁਰੂ ਕੀਤਾ ਅਤੇ ਪਸ਼ੂ ਪਾਲਣ ਦਾ ਵੀ ਕੰਮ ਸ਼ੁਰੂ ਕੀਤਾ ਇਸਦੇ ਨਾਲ ਨਾਲ ਹੁਣ ਉਹ ਮੁਰਗੀ ਪਾਲਣ ਦਾ ਕੰਮ ਵੀ ਸ਼ੁਰੂ ਕਰਨ ਜਾ ਰਿਹਾ ਹੈ ਉਸਨੇ ਆਪਣੇ ਨਾਲ ਨਾਲ ਹੋਰ ਵੀ ਪੰਦਰ੍ਹਾਂ ਵੀਹ ਲੋਕਾਂ ਨੂੰ ਰੁਜ਼ਗਾਰ ਦਿੱਤਾ ਹੈ ਰੁਜ਼ਗਾਰ ਦਾ ਸਾਧਨ ਬਣਾਇਆ ਹੈ ਉਸ ਦੇ ਦੁਆਰਾ ਪੈਦਾ ਕੀਤੀ ਗਈ ਫਸਲ ਬਿਨਾਂ ਕੈਮੀਕਲ ਤੋਂ ਹੁੰਦੀ ਹੈ ਉਹ ਦੇਸੀ ਖਾਦਾਂ ਦਾ ਪ੍ਰਯੋਗ ਕਰਦਾ ਹੈ ਗੱਲ ਕੀਤੀ ਜਾਵੇ ਤਾਂ ਉਸਦੀ ਫਸਲ ਅਤੇ ਦੁੱਧ ਦੀ ਅਤੇ ਉਸਦੀ ਫਸਲ ਅਤੇ ਦੁੱਧ ਸ਼ਹਿਰ ਤੱਕ ਪਹੁੰਚਾਈ ਜਾਂਦੀ ਹੈ ਨਾਲ ਲੱਗਦੇ ਪੰਦਰ੍ਹਾਂ ਪਿੰਡਾਂ ਦੇ ਲੋਕ ਉਸਦੀ ਫਸਲ ਖਰੀਦਣੀ ਚਾਹੁੰਦੇ ਹਨ ਇਸਦੇ ਨਾਲ ਨਾਲ ਉਹ ਇਹ ਵਪਾਰ ਕਰਕੇ ਸਾਲ ਦੇ ਵਿੱਚ ਘੱਟੋ ਘੱਟ ਦਸ ਬਾਰ੍ਹਾਂ ਲੱਖ ਦੀ ਕਮਾਈ ਕਰ ਲੈਂਦਾ ਹੈ ਇਸ ਨੌਜਵਾਨ ਤੋਂ ਪ੍ਰੇਰਿਤ ਹੋ ਕੇ ਹੋਰ ਵੀ ਕਈ ਲੋਕ ਨੇ ਜੋ ਆਪਣਾ ਵਪਾਰ ਸ਼ੁਰੂ ਕਰਨ ਜਾ ਰਹੇ ਹਨ ਇਸਦੇ ਇਲਾਵਾ ਵੀ ਸਾਡੇ ਨਵਾਂਸ਼ਹਿਰ ਦੇ ਲੋਕ ਭਾਈਚਾਰੇ ਕਾਫੀ ਵਪਾਰ ਕਰਦੇ ਹਨ